ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਤੁਹਾਡੀ ਇੱਕ ਹੈਲਪ ਚਾਹੀਦੀ ਸੀ ਮੈਂ ਇੱਥੇ ਘੁੰਮਣ ਆਈ ਹਾਂ ਐਜ਼ ਆ ਟੂਰਿਸਟ ਅਤੇ ਮੈਂ ਇੱਥੇ ਦੇਖਿਆ ਗੁਰਦੁਆਰਾ ਸਾਹਿਬ ਹੈਗੇ ਟੁੱਟੀ ਗੰਢੀ ਸਾਹਿਬ ਅਤੇ ਮੈਂ ਸੋਚਿਆ ਮੈਂ ਇੱਥੇ ਦਰਸ਼ਨ ਕਰ ਲਵਾਂ ਅਤੇ ਤੁਸੀਂ ਮੈਨੂੰ ਉਹ ਗੁਰਦੁਆਰਾ ਸਾਹਿਬ ਦੀ ਹਿ ਹਿਸਟਰੀ ਦੱਸ ਦਿਉਂਗੇ ਕੀ ਹੈ ਇਤਿਹਾਸ ਹਾਂਜੀ

ਅੱਛਾ ਹਾਂਜੀ ਜ਼ਰੂਰ ਜੀ

ਅੱਛਾ ਜੀ ਠੀਕ ਆ ਬਸ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਠੀਕ ਤੁਸੀਂ ਮ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਲਈ ਠੀਕ ਆ ਜੀ ਠੀਕ ਹੈ ਜੀ ਧੰਨਵਾਦ